ਟੈਕਨੋਲਜੀ ਵਿੱਚ ਬਹੁਤ ਸਾਰੀਆਂ ਐਪਸ ਆਈਆਂ ਜਿਵੇਂ ਕਿ ਇੰਸਟਾਗ੍ਰਾਮ ਵਟਸਅੱਪ ਸਨੈਪਚੈਟ ਸ਼ੇਅਰਚੈਟ ਪਰ ਮੇਰੀ ਸਭ ਤੋਂ ਜ਼ਿਆਦਾ ਜਿਹੜੀ ਚੇਂਜ ਕੀਤੀ ਦਿਲਚਸਪੀ ਉਹ ਕੀਤੀ ਇੰਸਟਾਗ੍ਰਾਮ ਨੇ ਕਿਉਂਕਿ ਇੰਸਟਾਗ੍ਰਾਮ 'ਤੇ ਆਪਾਂ ਵੀਡੀਓਸ ਬਣਾ ਸਕਦੇ ਹਾਂ ਆਪਣੀਆਂ ਗੱਲਾਂ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ ਵੀਡੀਓ ਰਾਹੀਂ ਜਿਹਦੇ ਨਾਲ ਕਿ ਸਾਨੂੰ ਬਹੁਤ ਸਾਰਾ ਮਤਲਬ ਕਈ ਲੋਕ ਅੱਜ ਕੱਲ੍ਹ ਵੀਡੀਓਸ ਤੋਂ ਵੀਡੀਓਸ ਬਣਾ ਕੇ ਪੈਸਾ ਕਮਾਉਂਦੇ ਹੈ ਅਤੇ ਇਸ ਲਈ ਮੇਰੀ ਟੈਕਨੋਲਜੀ ਨੇ ਸਭ ਤੋਂ ਜ਼ਿਆਦਾ ਦਿਲਚਸਪੀ ਚੇਂਜ ਕੀਤੀ ਹੈ ਇੰਸਟਾਗ੍ਰਾਮ ਨੇ ਦੂਸਰਾ ਆਪਾਂ ਕਹਿ ਸਕਦੇ ਹਾਂ ਵਟਸਅੱਪ ਜਿਹਦੇ ਨਾਲ ਅਸੀਂ ਆਪਾਂ ਗੱਲ ਈਜਲੀ ਕਰ ਸਕਦੇ ਹਾਂ ਚਾਹੇ ਕੋਈ ਬਾਹਰ ਬੈਠਾ ਜਿਵੇਂ ਕਿ ਕੈਨੇਡਾ ਹੈ ਨਾ ਅਸਟ੍ਰੇਲੀਆ ਕਿਤੇ ਵੀ ਹੈ ਤਾਂ ਅਸੀਂ ਵਟਸਅੱਪ ਤੋਂ ਉਹਦੇ ਨਾਲ ਈਜਲੀ ਗੱਲ ਕਰ ਸਕਦੇ ਹਾਂ ਜਿਹਦੇ ਨਾਲ ਕਿ ਆਪਾਂ ਆਪਾਂ ਨੂੰ ਕਿਸੇ ਨਾਲ ਵੀਡੀਓ ਕੌਲ ਵਗੈਰਾ ਵੀ ਹੋ ਸਕਦੀ ਹੈ ਸਭ ਕੁਛ ਹੋ ਸਕਦਾ ਤਾਂ ਜਿਹਦੇ ਨਾਲ ਆਪਾਂ ਨੂੰ ਉਹ ਬੰਦਾ ਆਪਣੇ ਕੋਲ ਬੈਠਾ ਹੀ ਫੀਲ ਹੁੰਦਾ ਵੀ ਆਪਾਂ ਉਹਨੂੰ ਮਿਲ ਚੁੱਕੇ ਹਾਂ ਇੱਦਾਂ ਹੀ ਲੱਗਦਾ ਹੈ ਤਾਂ ਇਸ ਲਈ ਸਭ ਤੋਂ ਜ਼ਿਆਦਾ ਜਿਹੜਾ ਚੇਂਜ ਕੀਤਾ ਇਨਵਾਇਰਮੈਂਟ ਸਾਰਾ ਟੈਕਨੋਲਜੀ ਨੇ ਉਹ ਹੈ ਵਟਸਅੱਪ ਜਿਹਦੇ ਨਾਲ ਕਿ ਆਪਾਂ ਸਟੇਟਸ ਲਗਾ ਡਾਲ ਸਕਦੇ ਹਾਂ ਜਿਹਦੇ 'ਤੇ ਆਪਾਂ ਵੀਡੀਓਸ ਸ਼ੇਅਰ ਕਰ ਸਕਦੇ ਹਾਂ ਲੋਕਾਂ ਨੂੰ ਆਪਣੀ ਲੋਕੇਸ਼ਨ ਈਜਲੀ ਸ਼ੇਅਰ ਕਰ ਸਕਦੇ ਹਾਂ ਤਾਂ ਆਪਾਂ ਬੈਠੇ ਹੋਏ ਸਾਰੀ ਇਨਫੋਰਮੇਸ਼ਨ ਵੀ ਇੱਕ ਦੂਸਰੇ ਦੀ ਲੈ ਸਕਦੇ ਹਾਂ